ਹੈਲੋ ਡੋਕਟਰ ਕਮਲਪ੍ਰੀਤ ਬੋਲਦੇ ਪਏ ਜੇ ਹਾਂਜੀ ਮੈਮ ਮੈਨੂੰ ਨਾ ਖਾਂਸੀ ਜੁਖਾਮ ਸੀਗਾ ਬਹੁਤ ਜ਼ਿਆਦਾ ਅਤੇ ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਕੀ ਤੁਸੀਂ ਅਪੋਆਇੰਟਮੈਂਟ ਦੇ ਸਕਦੇ ਹੋ ਮੈਨੂੰ ਕਿੱਥੇ ਮਿਲੋਗੇ ਹਾਂਜੀ ਹਾਂਜੀ ਠੀਕ ਹਾਂਜੀ ਠੀਕ ਆ ਅਤੇ ਮੈਮ ਕੋਈ ਮੈਡੀਸਨ ਵਗੈਰਾ ਲੈ ਸਕਦੀ ਹਾਂ ਮੈਂ ਹਾਂਜੀ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅਤੇ ਮੈਮ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੱਸਿਆ ਜੀ

ਠੀਕ ਠੀਕ ਹਾਂਜੀ ਹਾਂਜੀ ਠੀਕ ਓਕੇ ਜੀ ਠੀਕ ਠੀਕ ਹਾਂਜੀ ਓਕੇ